ਭੰਗੜੇ ਦੇ ਪ੍ਰਦਰਸ਼ਨ ਲਈ ਆਮ ਤੌਰ 'ਤੇ ਬੰਦੇ ਕੁੜਤੇ ਪਜਾਮੇ ਅਤੇ ਚਾਦਰੇ ਪਾਉਂਦੇ ਆ ਅਤੇ ਲੇਡੀਜ਼ ਸਲਵਾਰ ਸੂਟ ਅਤੇ ਘੱਗਰਾ ਪਾਉਂਦੀਆਂ ਸਲਵਾਰ ਸੂਟ ਦੇ ਨਾਲ ਫੁਲਕਾਰੀ ਵੀ ਲਈ ਜਾਂਦੀ ਹੈ ਘੱਗਰੇ 'ਤੇ ਵੀ ਫੁਲਕਾਰੀ ਵਰਤੀ ਜਾਂਦੀ ਹੈ ਅਤੇ ਇਹ ਜਿਹੜੇ ਕੋਸਟਿਊਮ ਹੈ ਇਹ ਇਹ ਸਾਰੇ ਗੂੜ੍ਹੇ ਰੰਗਾਂ ਦੇ ਹੁੰਦੇ ਹੈ ਇਹਨਾਂ 'ਤੇ ਹੈਂਡ ਵਰਕ ਅਤੇ ਮਿਰਰ ਵਰਕ ਵੀ ਕੀਤਾ ਹੁੰਦਾ ਜੋ ਇਹ ਡਾਂਸ ਕਰਨ ਵਾਲਿਆਂ ਨੂੰ ਹੋਰ ਆਕਰਸ਼ਿਤ ਬਣਾਉਂਦੀਆਂ ਇਹ ਬੰਦੇ ਜਿਹੜੇ ਕੁੜਤੇ ਪਜਾਮੇ ਦੇ ਨਾਲ ਕੈਂਠਾ ਅਤੇ ਤੁਰਲੇ ਵਾਲੀ ਪੱਗ ਬੰਨ੍ਹਦੇ ਹੈ ਅਤੇ ਪੈਰਾਂ 'ਚ ਪੰਜਾਬੀ ਜੁੱਤੀ ਪਾਉਂਦੇ ਆ ਅਤੇ ਬੁ ਲੇਡੀਜ਼ ਜਿਹੜੀ ਸਲਵਾਰ ਸੂਟ ਅਤੇ ਘੱਗਰੇ ਦੇ ਉੱਤੇ ਜਿਵੇਂ ਉਹ ਪਿੱਪਲ ਪੱਤੀਆਂ ਕੰਨਾਂ ਦੇ ਵਿੱਚ ਸਿਰ 'ਤੇ ਸੱਗੀ ਫੁੱਲ ਲਾਉਂਦੀਆਂ ਕੰਨ ਸਿਰ 'ਤੇ ਸੱਗੀ ਫੁੱਲ ਅਤੇ ਪੈਰ ਵਾਲਾਂ 'ਚ ਪਰਾਂਦੀ ਪਾਉਂਦੀਆਂ ਪੈਰਾਂ 'ਚ ਪੰਜਾਬੀ ਜੁੱਤੀ ਪਾਉਂਦੀਆਂ ਅਤੇ ਝਾਂਜਰਾਂ ਪਾਉਂਦੀਆਂ ਅਤੇ ਬਾਹਾਂ ਚੂੜਾ ਪਾਉਂਦੀਆਂ ਇਹ ਜਿਹੜਾ ਕੋਸਟਿਊਮ ਹੈ ਇਹ ਗੂੜ੍ਹੇ ਰੰਗਾਂ ਦਾ ਤਾਂ ਹੁੰਦਾ ਹੀ ਹੈ ਇਹ ਕੋਸਟਿਊਮ ਭੰਗੜਾ ਡਾਂਸਰਾਂ ਨੂੰ ਹੋਰ ਆਕਰਸ਼ਿਤ ਬਣਾਉਂਦਾ ਹੋਰ ਆਕਰਸ਼ਿਤ ਬਣਾਉਂਦਾ ਪਹਿਲਾਂ ਤਾਂ ਜਿਵੇਂ ਭੰਗੜਾ ਮੁੰਡੇ ਹੀ ਪਾਉਂਦੇ ਸੀ ਅਤੇ ਹੁਣ ਅੱਜ ਕੱਲ੍ਹ ਕੁੜੀਆਂ ਵੀ ਭੰਗੜਾ ਪਾਉਂਦੀਆਂ ਭੰਗੜਾ ਆਪਣੇ ਪੰਜਾਬ ਦਾ ਲੋਕ ਨਾਚ ਹੈ ਭੰਗੜਾ ਡਾਂਸਰ ਇਹ ਪੋਸ਼ਾਕ ਪਾ ਕੇ ਆਪਣੇ ਪੰਜਾਬ ਦੇ ਸੱਭਿਆਚਾਰ ਨੂੰ ਪੇਸ਼ ਕਰਦੇ ਹੈ